ਮੈਂ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਜਿਸ ਕਰਕੇ ਮੈਂ ਇਸ ਧਰਮ ਦੇ ਰੀਤੀ ਰਿਵਾਜ਼ ਅਤੇ ਅਤੇ ਅਤੇ ਪਰੰਪਰਾਵਾਂ ਦਾ ਪੂਰਾ ਪਾਲਣ ਕਰਦਾ ਹਾਂ ਇਸ ਵਿੱਚ ਦੱਸਿਆ ਜਾਂਦਾ ਹੈ ਕਿ ਕੇਸ ਰੱਖਣਾ ਜੋ ਕਿ ਇਹਦੇ ਰੀਤੀ ਰਿਵਾਜ਼ ਹਨ ਅਤੇ ਸੱਭਿਆਚਾਰ ਨਾਲ ਰਹਿਣਾ ਇੱਕ ਦੂਜੇ ਨਾਲ ਬਣਾ ਕੇ ਰੱਖਣੀ ਅਤੇ ਝੂਠ ਨਾ ਬੋਲਣਾ ਇਹਨਾਂ ਪਰੰਪਰਾਵਾਂ ਦਾ ਪੂਰਾ ਪਾਲਣ ਕੀਤਾ ਜਾਂਦਾ ਹੈ ਇਸ ਵਿੱਚ ਲੰਗਰ ਛਕਾਉਣਾ ਅਤੇ ਇਸ ਚੀਜ਼ ਅਤੇ ਧਾਰਮਿਕ ਥਾਵਾਂ 'ਤੇ ਘੁੰਮਣ ਨੂੰ ਵੀ ਪ੍ਰਮੁੱਖ ਰੱਖਿਆ ਜਾਂਦਾ ਹੈ